ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਹੈ ਪੰਜ ਕੰਟਰੀਜ ਵਰਲਡ ਦੀਆਂ ਕੁਝ ਇਸ ਪ੍ਰਕਾਰ ਹੈ ਜੋ ਕਿ ਮੈਨੂੰ ਚੇਤਾ ਹੈ ਪਹਿਲੀ ਰਸ਼ੀਆ ਦੂਜੀ ਕੈਨੇਡਾ ਤੀਜੀ ਚਾਈਨਾ ਚੌਥੀ ਦੁਬਈ ਅਤੇ ਪੰਚਵੀ ਜੋ ਕਿ ਆਖਰੀ ਹੈ ਉਹ ਹੈ ਆਸਟਰੇਲੀਆ